ਗੱਤਕਾ ਸਿੱਖਾਂ ਦੀ ਹਰਮਨ ਪਿਆਰੀ ਖੇਡ ਹੈ ਇਹ ਗੁਰਦੁਆਰਾ ਉਤਸਵਾਂ ਨਗਰ ਕੀਰਤਨਾਂ ਆਦਿ ਵਿੱਕ ਵਿੱਚ ਵੇਖਣ ਨੂੰ ਮਿਲਦੀ ਹੈ ਸਕੂਲਾਂ ਕਾਲਜਾਂ ਵਿੱਚ ਵੀ ਇਸ ਦੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਗੱਤਕਾ ਇਕ ਜੰਗੀ ਹੁਨਰ ਵੀ ਹੈ ਇਸ ਵਿੱਚ ਵਿਰੋਧੀ ਧਿਰ ਉੱਪਰ ਵਾਰ ਕਰਨ ਅਤੇ ਰੋਕਣ ਦਾ ਅਭਿਆਸ ਹੁੰਦਾ ਹੈ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਸੈਨਿਕ ਲਈ ਗੱਤਕਾ ਸਿੱਖਣਾ ਜ਼ਰੂਰੀ ਹੁੰਦਾ ਸੀ ਗੱਤਕਿਆਂ ਦੀ ਸਿਖਲਾਈ ਡੰਡੇ ਅਤੇ ਸੋਟਿਆਂ ਤੋਂ ਸ਼ੁਰੂ ਹੋ ਕੇ ਤਲਵਾਰ ਚਲਾਉਣ ਤੱਕ ਹੈ ਸਾਢੇ ਤਿੰਨ ਹੱਥ ਲੰਬਾ ਡੰਡਾ ਅਤੇ ਛੋਟੀ ਢਾਲ ਡੰਡੇ ਉੱਪਰ ਚੰਮ ਦਾ ਖੋਲ ਚੜਿਆ ਹੁੰਦਾ ਹੈ ਸੱਜੇ ਹੱਥ ਵਿੱਚ ਗੱਤਕਾ ਖਬਰ ਹੱਥ ਵਿੱਚ ਲੈ ਕੇ ਦੋ ਜਣੇ ਆਪਸ ਵਿੱਚ ਖੇਡਦੇ ਹਨ ਇਸ ਖੇਡ ਵਿੱਚ ਉਸਤਾਦਾਂ ਦੇ ਆਪੋ ਆਪਣੇ ਅਖਾੜੇ ਹੁੰਦੇ ਹਨ ਇਸ ਵਿੱਚ ਚਾਲ ਚੱਲਣ ਨੇਕ ਰੱਖਣਾ ਹੁੰਦਾ ਹੈ ਬਜ਼ੁਰਗ ਜਨਾਨੀਆਂ 'ਤੇ ਵਾਰ ਨਾ ਕਰਕੇ ਉਹਨਾਂ ਦੀ ਢਾਲ ਬਣਨਾ ਹੁੰਦਾ ਹੈ ਇਸ ਲਈ ਸਾਦੀ ਸ਼ੁੱਧ ਖੁਰਾਕ ਖਾਣੇ ਹੁੰਦੇ ਹੈ ਨਸ਼ੇ ਦਾ ਸੇਵਨ ਨਹੀਂ ਕਰਨਾ ਹੁੰਦਾ ਪੰਜਾਬ ਵਿੱਚ ਨਸ਼ਿਆਂ ਦਾ ਰੁਝਾਨ ਦਿਨ ਬ ਦਿਨ ਲਗਾਤਾਰ ਵੱਧਦਾ ਜਾ ਰਿਹਾ ਹੈ ਨਸ਼ਿਆਂ ਨੂੰ ਰੋਕਣ ਲਈ ਸਾਨੂੰ ਵਿਦਿਆਰਥੀ ਨੌਜਵਾਨ ਪੀੜ੍ਹੀ ਦਾ ਧਿਆਨ ਖੇਡਾਂ ਵਿੱਚ ਲਗਾਉਣਾ ਚਾਹੀਦਾ ਹੈ ਖੇਡਾਂ ਦਾ ਸਭ ਤੋਂ ਨਜ਼ਦੀਕੀ ਰਿਸ਼ਤਾ ਸਰੀਰ ਦੀ ਬਣਤਰ ਨਾਲ ਹੁੰਦਾ ਹੈ ਗੱਤਕਾ ਦਾ ਰਿਸ਼ਤਾ ਵੀ ਸਰੀਰ ਦੀ ਬਣਤਰ ਨਾਲ ਹੈ ਗੱਤਕਾ ਵਿੱਚ ਕਈ ਪ੍ਰਕਾਰ ਦੀਆਂ ਫਿਜੀਕਲ ਐਕਟੀਵਿਟੀਜ਼ ਮੌਜੂਦ ਹੁੰਦੀਆਂ ਹਨ ਜਿਹਨਾਂ ਨਾਲ ਸਾਡਾ ਸਰੀਰ ਫਿਟ ਰਹਿੰਦਾ ਹੈ ਅਤੇ ਦਿਮਾਗ ਤੰਦਰੁਸਤ ਰਹਿੰਦਾ ਹੈ ਇਹਨਾਂ ਵਿੱਚੋਂ ਇੱਕ ਨਿਹੰਗ ਸਿੰਘ ਦੀ ਹਰਮਨ ਪਿਆਰੀ ਖੇਡ ਗੱਤਕਾ ਹੈ ਗੱਤਕਾ ਫਾਰਸੀ ਦਾ ਸ਼ਬਦ ਖੁਦ ਕਾ ਸ਼ਬਦ ਤੋਂ ਲਿਆ ਗਿਆ ਹੈ ਪੰਜਾਬੀ ਭਾਸ਼ਾ ਦੇ ਲੋਕਾਂ ਦੇ ਮੂੰਹ ਚੜ ਕੇ ਗੱਤਕਾ ਬਣ ਗਿਆ ਹੈ ਗੱਤਕਾ ਵਿੱਚ ਹਰ ਵੇਲੇ ਹਰ ਪਲ ਹਰ ਘੜੀ ਆਤਮ ਰਕਸ਼ਾ ਦੀ ਗੱਲ ਕੀਤੀ ਜਾਂਦੀ ਹੈ ਗੱਤਕਾ ਸਿੱਖਣਾ ਹਰ ਮੁੰਡੇ ਹਰ ਕੁੜੀ ਲਈ ਜੋ ਕਿ ਸਿੱਖ ਧਰਮ ਨਾਲ ਸੰਬੰਧਿਤ ਹੈ ਜਾਂ ਨਹੀਂ ਹੈ ਜ਼ਰੂਰੀ ਹੈ ਗੱਤਕਾ ਹਰ ਸਮੇਂ ਹਰ ਘੜੀ ਹਰ ਪਲ ਹਰ ਵਕਤ ਕੰਮ ਆ ਸਕਦੀਆ ਹਨ ਕਿਸੇ ਵੀ ਵਕਤ ਸਵੈ ਸਵੈ ਸ਼ਕਤੀਕਰਨ ਦੀ ਲੋੜ ਪੈ ਸਕਦੀ ਹੈ ਇਸ ਨਾਲ ਅਸੀਂ ਆਪਣੇ ਆਪ ਨੂੰ ਸੁਰੱਖਿਤ ਰੱਖ ਸਕਦੇ ਹਾਂ ਸੈਲਫ ਡਿਫੈਂਸ ਹਰ ਜਗ੍ਹਾ 'ਤੇ ਕੰਮ ਆਉਂਦਾ ਹੈ ਅੱਜ ਕੱਲ੍ਹ ਤਾਂ ਫੌਜ ਵਿੱਚ ਵੀ ਇਹ ਵੱਡੀ ਮਾਨਤਾ ਪ੍ਰਾਪਤ ਖੇਡ ਮੰਨੀ ਜਾਂਦੀ ਹੈ ਇਸ ਵਿੱਚ ਵੱਖੋ ਵੱਖ ਗੱਭਰੂ ਆਪਣੇ ਜੌਹਰ ਦਿਖਾਉਂਦੇ ਹਨ ਜਿਸ ਨਾਲ ਉਹਨਾਂ ਵਿੱਚ ਇਕਾਗਰਤਾ ਪ੍ਰਾਪਤ ਹੁੰਦੀ ਪ ਹੁੰਦੀ ਹੈ ਅਤੇ ਆਪਸੀ ਪ੍ਰੇਮ ਬਣਿਆ ਰਹਿੰਦਾ ਹੈ ਗੱਤਕਾ ਇੱਕ ਜੰਗੀ ਹੁਨਰ ਹੈ ਇਸ ਲਈ ਇਹ ਲੜਾਈ ਨਾਲ ਸੰਬੰਧਿਤ ਹੈ ਜੇਕਰ ਤੁਹਾਡੇ 'ਤੇ ਬਿਨਾਂ ਦੱਸੇ ਕੋਈ ਇੱਕਦਮ ਆਕਰਮਣ ਕਰਦਾ ਹੈ ਤਾਂ ਤੁਸੀਂ ਆਪਣੀ ਸੈਲਫ ਡਿਫੈਂਸ ਕਰ ਸਕਦੇ ਹੋ ਗੱਤਕਾ ਇਸਦਾ ਇੱਕ ਅਣਮੁੱਲਾ ਦ ਦੇਣ ਹੈ ਸਾਡੇ ਗੁਰੂਆਂ ਨੇ ਸਾਨੂੰ ਲੋੜ ਪੈਣ 'ਤੇ ਸ਼ਸਤਰ ਚੁੱਕਣ ਦੀ ਵਿੱਦਿਆ ਸਿਖਾਉਣ ਲਈ ਗੱਤਕਾ ਦਾ ਹੁਨਰ ਦਿੱਤਾ ਹੈ ਇੱਕ ਯੋਧਾ ਹਰ ਪਲ ਹਰ ਵਕਤ ਹਰ ਘੜੀ ਕਿਸੇ ਵੀ ਸਿਚੁਏਸ਼ਨ ਲਈ ਤਿਆਰ ਰਹਿਣਾ ਚਾਹੀਦਾ ਹੈ